ਹੈਲੋ ਹਾਂਜੀ ਦੱਸੋ ਅੱਛਾ ਜੀ ਮਿਨਸ ਤੁਹਾਡਾ ਕਿਹੜੇ ਸੀਮ ਦਾ ਆ ਕਿਹੜੇ ਅੱਛਾ ਜੀ ਅਤੇ ਮੈਮ ਟੋਪ ਅੱਛਾ ਜੀ ਅਤੇ ਮੈਮ ਪ੍ਰੋਬਲਮ ਕੀ ਆ ਮੀਨਸ ਤੁਹਾਨੂੰ ਪ੍ਰੋਬਲਮ ਕੀ ਆਉਂਦੀ ਹੈ ਜਿਹੜੀ ਤੁਸੀਂ ਪੋਰਟ ਕਰਵਾਉਣਾ ਚਾਹੁੰਦੇ ਹੋ ਓਕੇ ਜੀ ਅੱਛਾ ਜੀ ਅੱਛਾ ਜੀ ਅਤੇ ਮੀਨਸ ਤੁਸੀਂ ਕਿਹੜੀ ਸਿਮ ਟਰਾਂਸਫਰ ਕਰਨਾ ਚਾਹੁੰਦੇ ਹੋ ਜੇ ਤੁਹਾਡੇ ਕੋਲ ਜੀਓ ਆ ਓਕੇ ਤੁਹਾਡੇ ਕੋਲ ਇਹਦਾ ਕੋਈ ਸਪੈਸੇਫਿਕ ਰੀਜਨ ਹੋਵੇ ਵੀ ਤੁਸੀਂ ਏਅਰਟੈੱਲ ਦੀ ਕਰਵਾਉਣੀ ਆ ਓਕੇ ਸੋ ਠੀਕ ਹੈ ਮੈਮ ਆਪਾਂ ਮਤਲਬ ਕਿ ਏਅਰਟੈਲ ਦੇ ਵਿੱਚ ਟ੍ਰਾਂਸਫਰ ਕਰ ਦੇਵਾਂਗੇ ਅਤੇ ਏਅਰਟੈਲ ਦੇ ਵਿੱਚ ਮੀਨਸ ਬਹੁਤ ਹੀ ਜ਼ਿਆਦਾ ਆਪਣੇ ਕੋਲ ਜਿਹੜੇ ਨੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਪਣੇ ਕੋਲ ਸਾਰੇ ਵੈਲਿਡ ਹੈਗੇ ਨੇ ਮਤਲਬ ਕਿ ਜਿੰਨੀਆਂ ਵੀ ਔਪਸ਼ਨਸ ਨੇ ਬਹੁਤ ਸਾਰੇ ਬੈਲੈਂਸ ਔਪਸ਼ਨ ਨੇ ਓਪਨ 'ਚ ਵੀ ਇੱਥੇ ਆਪਾਂ ਨੂੰ ਪ੍ਰੋਵਾਈਡ ਹੁੰਦੇ ਆ ਇਸ ਤੋਂ ਇਲਾਵਾ ਜਿਵੇਂ ਕਿਉਂਕਿ ਤੁਸੀਂ ਏਅਰਟੈਲ ਦੇ ਵਿੱਚ ਜੇ ਮੰਥਲੀ ਰਿਚਾਰਜ ਕਰਵਾਉਂਦੇ ਹੋ ਤਾਂ ਕੋਈ ਵੀ ਡੇਢ ਜੀ ਬੀ ਵਾਲਾ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ ਪੰਜ ਸੌ ਐਮ ਬੀ ਡੇਲੀ ਦਾ ਫਰੀ ਮਿਲਦਾ ਆ ਸੋ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਰਹੇਗਾ ਸੋ ਤੁਸੀਂ ਦੇਖ ਲਓ ਵੀ ਕਿੱਦਾਂ ਕਿੱਦਾਂ ਕਰਨੀ ਆ ਫਿਰ ਤੁਸੀਂ ਮੈਨੂੰ ਟਾਈਮ ਦੱਸ ਦਿਓ ਮੈਂ ਅਸੀਂ ਸ਼ੋਪ 'ਤੇ ਹੀ ਹੁੰਦੇ ਆ ਸਾਡੀ ਸ਼ੋਪ ਸੁਬਹਾ ਅੱਠ ਵਜੇ ਓਪਨ ਹੋ ਜਾਂਦੀ ਏ ਅਤੇ ਰਾਤ ਨੂੰ ਗਿਆਰ੍ਹਾਂ ਵਜੇ ਤੱਕ ਓਪਨ ਰਹਿੰਦੀ ਹੈ ਸੋ ਜਦ ਮਰਜ਼ੀ ਆ ਕੇ ਸਿਮ ਪੋਰਟ ਕਰਵਾ ਸਕ ਹਾਂਜੀ ਹੈਂਜੀ ਮੈਮ ਬਸ ਆਪਣਾ ਤਾਂ ਦਸ ਮਿੰਟਾਂ ਦਾ ਪ੍ਰੋਸੈਸ ਹੁੰਦਾ ਆ ਬਸ ਆਪਾਂ ਔਨਲਾਈਨ ਚੜ੍ਹਾਉਣਾ ਹੁੰਦਾ ਆ ਸਿਮ ਪੋਰਟ ਕਰਵਾਉਣਾ ਹੁੰਦਾ ਆ ਆਪਣਾ ਹੋਜੂਗਾ ਹਾਂਜੀ ਅਤੇ ਹੋਰ ਕੋਈ ਇਸ਼ੂ ਮੈਮ ਕੋਈ ਓਕੇ ਹੋਰ ਮੀਨਸ ਜੇ ਤੁਹਾਨੂੰ ਕੁਛ ਇੱਦਾਂ ਦਾ ਹੋਵੇ ਵੀ ਤੁਸੀਂ ਨੈਟਵਰਕ ਵੀ ਆਪਣਾ ਘਰ ਦੇ ਵਿੱਚ ਚਲਵਾਉਣਾ ਹੋਵੇ ਏਅਰਟੈਲ ਦਾ ਤਾਂ ਤੁਹਾਡਾ ਉਹ ਵੀ ਅਸੀਂ ਕਰ ਸਕਦੇ ਹਾਂ ਉਹਦੇ ਲਈ ਬਸ ਕੁਛ ਨਹੀਂ ਮੈਮ ਇੱਦਾਂ ਹੀ ਸੇਮ ਆਪਾਂ ਮਤਲਬ ਕਿ ਸਿਮ ਨਾਲ ਵੀ ਸਿੱਧਾ ਕਨੈਕਟ ਕਰਵਾ ਸਕਦੇ ਹਾਂ ਇੰਟਰਨੈਟ ਬਰੋਡਕਾਸਟਿੰਗ ਕਰ ਦਿੰਦੇ ਹਾਂ ਹਾਂਜੀ ਹਾਂਜੀ ਤੁਸੀਂ ਆਈਡੀਆ ਦੀ ਵੀ ਕਰਵਾ ਸਕਦੇ ਹੋ ਤੁਹਾਡੇ ਲਈ ਤੁਹਾਡੀ ਚੋਆਇਸ ਆਉਂਦੀ ਏ ਉਹ 'ਚ ਵੀ ਤੁਸੀਂ ਕਿਹੜਾ ਕਰਵਾਉਣਾ ਚਾਹੁੰਦੇ ਹੋ ਕਿਉਂਕਿ ਔਫਰ ਤਾਂ ਸਾਰੇ ਹੀ ਬਹੁਤ ਵਧੀਆ ਨੇ ਪਰ ਏਅਰਟੈਲ ਦੇ ਕੁਛ ਔਫਰ ਜ਼ਿਆਦਾ ਵਧੀਆ ਨੇ ਕਿਉਂਕਿ ਸਾਰਾ ਇੰਡੀਆ ਜਿਹੜਾ ਉਹ ਅੱਜ ਕੱਲ ਏਅਰਟੈਲ 'ਤੇ ਹੀ ਚੂਜ ਕਰ ਰਿਹਾ ਆ ਸੋ ਏਅਰਟੈਲ ਕੌਂਪਨੀ ਜ਼ਿਆਦਾ ਟੋਪ ਮਿਨਸ ਪ੍ਰੋਵਾਈਡ ਕਰ ਰਹੀ ਆ ਹਾਂਜੀ ਫਿਰ ਤੁਸੀਂ ਕੋਈ ਨਹੀਂ ਅਸੀਂ ਕਰ ਦੇਵਾਂਗੇ ਫਿਰ ਫਰੀ ਹੋ ਕੇ ਜਦੋਂ ਵੀ ਹੋਏ ਪਹਿਲਾਂ ਇੱਕ ਵਾਰ ਕੋਲ ਕਰ ਦਿਓ ਅਤੇ ਸਾਨੂੰ ਦੱਸ ਦਿਓ ਓਕੇ ਮੈਮ ਥੈਂਕ ਯੂ ਹੈਵ ਆ ਨਾਈਸ ਡੇਅ